ਸਤਿ ਸ਼੍ਰੀ ਅਕਾਲ ਕਟਾਣੀ ਢਾਬੇ ਤੋਂ ਬੋਲ ਰਹੇ ਹੋਂ ਮੈਂ ਇਕ ਆਡਰ ਕਰਨਾ ਹੈ ਸ਼ਾਹੀ ਪਨੀਰ ਬਣਵਾਉਣਾ ਹੈ ਉਸ ਦੇ ਵਿੱਚ ਘੱਟ ਮਸਾਲਾ ਅਤੇ ਔਨਲਾਈਨ ਪੇਮੈਂਟ ਕੀਤ ਕੀਤੀ ਜਾਉਗੀ ਅਤੇ ਆਪ ਦਾ ਬਹੁਤ ਬਹੁਤ ਧੰਨਵਾਦ